ਮੇਰੀ ਇੱਕ ਨਾ ਧਾਰਮਿਕ ਪ ਪ੍ਰਵਿਰਤੀ ਹੈ ਸ਼ੁਰੂ ਤੋਂ ਹੀ ਤਾਂ ਮੈਂ ਬਿਆਸ ਨਾਲ ਜੁੜੀ ਹੋਈ ਹਾਂ ਅਸਲ 'ਚ ਮੇਰੇ ਜੋ ਮਾਈਕਾ ਪਰਿਵਾਰ ਹੈ ਉਹ ਵੀ ਬਿਆਸ ਜਾਂਦੇ ਨੇ ਰਾਧਾ ਸੁਆਮੀ ਨੇ ਅਤੇ ਇੱਧਰ ਮੈਂ ਸਸੁਰਾਲ ਵਾਲੇ ਵੀ ਰਾਧਾ ਸੁਆਮੀ ਨੇ ਅਤੇ ਬਿਆਸ ਜਾ ਕੇ ਜੋ ਇੱਕ ਸਕੂਨ ਮਿਲਦਾ ਉਹ ਮੈਂ ਆਪਣੇ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਹੈਗੀ ਔਰ ਉੱਥੇ ਜਦੋਂ ਵੀ ਭੰਡਾਰਾ ਹੁੰਦਾ ਆ ਤਾਂ ਮੈਂ ਜ਼ਰੂਰ ਜਾਂਦੀ ਹਾਂ ਔਰ ਉੱਥੇ ਇੰਨੀ ਸੰਗਤ ਆਉਂਦੀ ਹੈ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਬਾਬਾ ਜੀ ਸਤਿਸੰਗ ਸੁਣਨ ਨੂੰ ਉਹ ਜਿਹਨੂੰ ਸੁਣ ਕੇ ਇੱਕ ਬਹੁਤ ਹੀ ਜ਼ਿਆਦਾ ਆਨੰਦ ਮਿਲਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਇਸ ਦੁਨੀਆਦਾਰੀ ਬਾਰੇ ਪਤਾ ਚੱਲਦਾ ਹੈ ਕਿ ਸੰਤ ਮੱਤ ਬਾਰੇ ਪਤਾ ਚੱਲਦਾ ਹੈ ਅਤੇ ਇੱਕ ਬਹੁਤ ਹੀ ਅਲੱਗ ਰੂਹਾਨੀਅਤ ਵਾਲਾ ਨਜ਼ ਨਜ਼ਾਰਾ ਜੋ ਸਾਨੂੰ ਮੈਨੂੰ ਦੇਖਣ ਨੂੰ ਮਿਲਦਾ ਹੈ ਮਹਿਸੂਸ ਕਰਨ ਮਿਲਦਾ ਉਹ ਮੈਨੂੰ ਸਿਰਫ ਸਿਰਫ ਬਿਆਸ ਜਾਂ ਸਤਿਸੰਗ ਘਰ ਜਾ ਕੇ ਹੀ ਮਿਲਦਾ ਹੈ